ਮੇਰਾ ਇਹ ਮੰਨਣਾ ਹੈ ਕਿ ਸਿੱਖਿਆ ਦੇ ਤੌਰ 'ਤੇ ਲੜਕੀਆਂ ਨੂੰ ਮੌਕੇ ਘੱਟ ਦਿੱਤੇ ਜਾਂਦੇ ਹਨ ਲੜਕਿਆਂ ਨੂੰ ਜ਼ਿਆਦਾ ਦਿੱਤੇ ਜਾਂਦੇ ਹਨ ਲੜਕੀਆਂ ਨੂੰ ਸਿਰਫ਼ ਘਰ ਦੇ ਕੰਮਾਂ ਵਿੱਚ ਹੀ ਲਗਾਇਆ ਲਗਾਇਆ ਜਾਂਦਾ ਹੈ ਉਹਨਾਂ 'ਤੇ ਪੈਸਾ ਘੱਟ ਖਰਚ ਕੀਤਾ ਜਾਂਦਾ ਹੈ ਜਿਹੜੀ ਹੁਸ਼ਿਆਰ ਲੜਕੀਆਂ ਹੁੰਦੀਆਂ ਉਹਨਾਂ ਨੂੰ ਵੀ ਪੜ੍ਹਨ ਦੇ ਮੌਕੇ ਨਹੀਂ ਦਿੱਤੇ ਜਾਂਦੇ ਸਿਰਫ਼ ਲੜਕਿਆਂ ਨੂੰ ਹੀ ਇਹ ਮੌਕੇ ਦਿੱਤੇ ਜਾਂਦੇ ਹਨ ਰੁਜ਼ਗਾਰ ਦੇ ਤੌਰ 'ਤੇ ਵੀ ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਨੌਕਰੀਆਂ ਲੜਕੇ ਹੀ ਕਰ ਰਹੇ ਹਨ ਲੜਕੀਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਚਾਹੇ ਉਹ ਸਿਕਓਰਟੀ ਗਾਰਡ ਦੀ ਹੋਵੇ ਜਾਂ ਕਿਸੇ ਕੰਪ ਸਰਕਾਰੀ ਜਾਂ ਪ੍ਰਾਈਵੇਟ ਕੰਪਨੀ ਵਿੱਚ ਹੋਵੇ ਉਹਨਾਂ ਨੂੰ ਨੌਕਰੀਆਂ ਦੀ ਪਹਿਲ ਨਹੀਂ ਦਿੱਤੀ ਜਾਂਦੀ ਇਸ ਕਰਕੇ ਇਹ ਬਿਲਕੁਲ ਗਲਤ ਹੈ ਲੜਕੀਆਂ ਨੂੰ ਵੀ ਬਰਾਬਰ ਦਾ ਦ ਬਰਾਬਰ ਦੀ ਸਮਾਨਤਾ ਮਿਲਣੀ ਚਾਹੀਦੀ ਹੈ ਸਮ ਸਾਡੇ ਸਮਾਜ ਵਿੱਚ ਲਿੰਗ ਅਸਮਾਨਤਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਤੀ ਤੀਸਰੇ ਸਮਾਜਿਕ ਸਥਿਤੀ ਲੜਕੀਆਂ ਦੀ ਬਹੁਤ ਬੁਰੀ ਹੈ ਰੋ ਰੂਪਨਗਰ ਜ਼ਿਲ੍ਹੇ ਵਿੱਚ ਦੇਖਿਆ ਗਿਆ ਹੈ ਕਿ ਰਾਤ ਨੂੰ ਲੜਕੀਆਂ ਜਦ ਕਦੀ ਵੀ ਲੜਕੀਆਂ ਇਕੱਲੀਆਂ ਨਹੀਂ ਜਾ ਸਕਦੀਆਂ ਨਸ਼ੇੜੀ ਮੁੰਡੇ ਅੱਜ ਕੱਲ੍ਹ ਬਹੁਤ ਘੁੰਮਦੇ ਹਨ ਅਤੇ ਠੀਕ ਵਿਵਹਾਰ ਨਹੀਂ ਕਰਦੇ ਇਸ ਕਰਕੇ ਬਹੁਤ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ